ਟੈਕਨੋਲੋਜੀ ਦਾ ਵਾਤਾਵਰਨ ਉੱਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ ਕਈ ਵਾਰ ਇਹ ਪ੍ਰਭਾਵ ਵਾਤਾਵਰਨ ਲਈ ਫ਼ਾਇਦੇਮੰਦ ਹੁੰਦਾ ਹੈ ਕਈ ਵਾਰ ਬਹੁਤ ਨੁਕਸਾਨਦੇਈ ਹੁੰਦਾ ਹੈ ਫ਼ਾਇਦੇਮੰਦ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਨਈਂ ਆ ਰਹੀ ਤਕਨੀਕਾਂ ਰਾਹੀਂ ਆਪਾਂ ਫਸਲ ਦੀ ਪੈਦਾਵਾਰ ਵਧਾ ਸਕਦੇ ਹਾਂ ਜਿਵੇਂ ਰੀਪੀਰੀਗੇਸ਼ਨ ਮੈਥਡ ਅਤੇ ਹੋਰ ਵੀ ਕਈ ਤਕਨੀਕਾਂ ਆ ਰਹੀਆਂ ਹਨ ਅਤੇ ਟਰੈਕਟਰ ਵਗੈਰਾ ਦੀ ਖੋਜ ਵੀ ਕੀਤੀ ਜਾ ਰਹੀ ਹੈ ਮਾੜਾ ਇਸ ਤਰ੍ਹਾਂ ਹੋ ਸਕਦਾ ਹੈ ਕਿ ਇਸ ਨਾਲ ਹਵਾ ਦੂਸ਼ਿਤ ਹੋ ਰਹੀ ਹੈ ਜਿਵੇਂ ਵਾਹਨਾਂ ਵਿੱਚੋਂ ਨਿਕਲਦਾ ਧੂੰਆ ਅਤੇ ਕਾਰਖਾਨਿਆਂ ਵਿਚੋਂ ਨਿਕਲਦਾ ਧੂੰਆਂ ਹਵਾ ਨੂੰ ਦੁਸ਼ਿਤ ਕਰ ਰਿਹਾ ਹੈ ਇਸ ਦੇ ਹੋਰ ਵੀ ਕਈ ਪ੍ਰਭਾਵ ਹਨ